ਜਿਵੇਂ ਕਿ ਸਾਡੇ ਨੇੜਲੇ ਹਸਪਤਾਲਾਂ ਵਿੱਚ ਬਹੁਤ ਹੀ ਸਾਫ਼ ਸਫ਼ਾਈ ਅਤੇ ਹਰ ਇੱਕ ਤਰ੍ਹਾਂ ਦੀ ਸੁਵਿਧਾ ਹੁੰਦੀ ਹੈ ਉੱਥੇ ਹਰ ਇੱਕ ਲੋੜੀਂਦੀ ਚੀਜ਼ ਮਿਲਦੀ ਹੈ ਲੇਕਿਨ ਆਮ ਤੌਰ 'ਤੇ ਪਿੰਡਾਂ ਵਿੱਚੋਂ ਆਉਣ ਵਾਲੇ ਲੋਕ ਉੱਥੇ ਬਹੁਤ ਹੀ ਜ਼ਿਆਦਾ ਗੰਦਗੀ ਫੈਲਾ ਦਿੰਦੇ ਹਨ ਇੱਕ ਇੱਕ ਮਰੀਜ਼ ਨਾਲ਼ ਦਸ ਦਸ ਜਣੇ ਹਸਪਤਾਲਾਂ ਵਿੱਚ ਆ ਜਾਂਦੇ ਆ ਜਿਸ ਨਾਲ਼ ਬ ਹੋਰ ਵੀ ਜ਼ਿਆਦਾ ਗੰਦਗੀ ਮੱਚਦੀ ਹੈ ਅਤੇ ਸਾਫ਼ ਸਫ਼ਾਈ ਵੀ ਭੰਗ ਹੋ ਜਾਂਦੀ ਹੈ ਇਸ ਨਾਲ਼ ਹਸਪਤਾਲਾਂ ਵਿੱਚ ਬਹੁਤ ਹੀ ਗੰਦ ਪੈਂਦਾ ਹੈ ਇਹਨਾਂ ਚੀਜ਼ਾਂ ਨੂੰ ਦੇਖਦੇ ਹੋਏ ਲੋਕਾਂ ਨੂੰ ਇਹਨਾਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਹੈ